ਡਾਂਸ ਡਾਂਸ ਇੱਕ ਬਹੁਤ ਵਧੀਆ ਪ੍ਰਕਿਰਿਆ ਹੈ ਡਾਂਸ ਕਰਨ ਨਾਲ ਬਹੁਤ ਹੀ ਜ਼ਿਆਦਾ ਖੁਸ਼ੀ ਮਿਲਦੀ ਹੈ ਡਾਂਸ ਕਰਨ ਨਾਲ ਹੱਥ ਪੈਰ ਚਲਦੇ ਰਹਿੰਦੇ ਨੇ ਅਤੇ ਸੁਸਤੀ ਪੈਂਦੀ ਨਹੀਂ ਡਾਂਸ ਬਹੁਤ ਵਧੀਆ ਪ੍ਰਕਿਰਿਆ ਹੈ ਡਾਂਸ ਕਰਦੇ ਸਮੇਂ ਬਹੁਤ ਚੰਗੀ ਪ੍ਰਭਾਵਿਤ ਹੁੰਦੇ ਹਨ ਡਾਂਸ ਕਰਨ ਸਮੇਂ ਸਾ ਕੁਛ ਸਾਨੂੰ ਕੁਛ ਨਹੀਂ ਪਤਾ ਲੱਗਦਾ ਕਿ ਸਾਨੂੰ ਕੋਈ ਕੀ ਦੇਖ ਰਿਹਾ ਜਾਂ ਕੋਈ ਸਾਡਾ ਮਜ਼ਾਕ ਉਡਾ ਰਿਹਾ ਜਾਂ ਕੋਈ ਸਾਨੂੰ ਕੁਛ ਕਹਿ ਰਿਹਾ ਡਾਂਸ ਕਰਦੇ ਸਮੇਂ ਬਸ ਸਿਰਫ ਡਾਂਸ ਹੀ ਡਾਂਸ ਦਿਖਦਾ ਹੈ ਡਾਂਸ ਸਾਨੂੰ ਬਹੁਤ ਚੁਸਤ ਅਤੇ ਤੰਦਰੁਸਤ ਰੱਖਦਾ ਹੈ ਡਾਂਸ ਕਰਨ ਨਾਲ ਸਿਹਤ ਬਹੁਤ ਵਧੀਆ ਰਹਿੰਦੀ ਹੈ ਸਿਹਤ ਵਧੀਆ ਰਹਿੰਦੀ ਹੈ ਡਾਂਸ ਕਰਨ ਨਾਲ ਕਿਉਂਕਿ ਡਾਂਸ ਕਰਨਾ ਹੱਥ ਪੈਰ ਚਲਦੇ ਰਹਿੰਦੇ ਹਨ ਅਤੇ ਦਿਮਾਗ ਵੀ ਬਹੁਤ ਫਰੈਸ਼ ਰਹਿੰਦਾ ਹੈ ਡਾਂਸ ਬਹੁਤ ਵਧੀਆ ਪ ਪਕਿਰਿਆ ਪ੍ਰਕਿਰਿਆ ਮੰਨੀ ਜਾਂਦੀ ਹੈ ਡਾਂਸ ਨੂੰ ਕਰਦੇ ਸਮੇਂ ਕੁਝ ਚੀਜ਼ਾਂ ਇਹੋ ਜਿਹੀਆਂ ਵੀ ਹੁੰਦੀਆਂ ਹਨ ਜਿਸ ਦੇ ਰਾਹੀਂ ਡਾਂਸ ਕਰਨ ਨਾਲ ਡਾਂਸ ਕਰਨ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ ਡਾਂਸ ਕਰਦੇ ਸਮੇਂ ਸਭ ਕੁਛ ਭੁੱਲ ਕੇ ਸਿਰਫ ਬਸ ਡਾਂਸ ਵੱਲ ਹੀ ਧਿਆਨ ਦੇਣਾ ਚਾਹੀਦਾ ਹੈ ਡਾਂਸ ਬਹੁਤ ਵਧੀਆ ਐਕਸਰਸਾਈਜ਼ ਮੰਨੀ ਜਾਂਦੀ ਹੈ ਜਿਸ ਜਿਵੇਂ ਕਿ ਡਾਂਸ ਕਰਦੇ ਹੋਏ ਹੱਥ ਪੈਰ ਚਲਦੇ ਹਨ ਅਤੇ ਬੰਦਾ ਤੰਦਰੁਸਤ ਰਹਿੰਦਾ ਹੈ ਤਾਂ ਜਿਹੜਾ ਬੰਦਾ ਤੰਦਰੁਸਤ ਰਹਿੰਦਾ ਹੈ ਡਾਂਸ ਕਰਦਾ ਰਹਿੰਦਾ ਹੈ ਉਹ ਬਿਮਾਰੀਆਂ ਤੋਂ ਬਹੁਤ ਹੀ ਦੂਰ ਰਹਿੰਦਾ ਹੈ ਉਸ ਨੂੰ ਬਿਮਾਰੀਆਂ ਬਿਲਕੁਲ ਵੀ ਨਹੀਂ ਲੱਗਦੀਆਂ ਅਤੇ ਉਹ ਹਮੇਸ਼ਾਂ ਸਿਹਤਮੰਦ ਰਹਿੰਦਾ ਹੈ ਡਾਂਸ ਕਰਨਾ ਹੀ ਚਾਹੀਦਾ ਹੈ ਡਾਂਸ ਕਰਨ ਲਈ ਕੋਈ ਵੀ ਉਮਰ ਨਹੀਂ ਦੇਖਣੀ ਚਾਹੀਦੀ ਚਾਹੇ ਬੰਦਾ ਛੋਟਾ ਹੋਵੇ ਵੱਡਾ ਹੋਵੇ ਸਭ ਨੂੰ ਡਾਂਸ ਕਰਨਾ ਚਾਹੀਦਾ ਹੈ ਡਾਂਸ ਕਰਨ ਨਾਲ ਸਿਹਤਮੰਦ ਰਹਿ ਰਹਿੰਦੇ ਹਨ ਡਾਂਸ ਬਹੁਤ ਹੀ ਵਧੀਆ ਪ੍ਰਕਿਰਿਆ ਮੰਨੀ ਜਾਂਦੀ ਹੈ ਡਾਂਸ ਕਰਨ ਨਾਲ ਬੰਦਾ ਤੰਦਰੁਸਤ ਚੁਸਤ ਰਹਿੰਦਾ ਹੈ ਅਤੇ ਉਹ ਉਸਨੂੰ ਸ ਸੁਸਤੀ ਨਹੀਂ ਪੈਂਦੀ ਡਾਂਸ ਇੱਕ ਬਹੁਤ ਹੀ ਵਧੀਆ ਪ੍ਰਕਿਰਿਆ ਮੰਨੀ ਜਾਂਦੀ ਹੈ